ਭਾਵੇ ਸਿਹਤ ਪ੍ਰਣਾਲੀ ਬਹੁਤ ਵਧੀਆ ਹੈ ਜਦੋਂ ਤੱਕ ਅਸੀਂ ਆਪਣੀ ਖੁਦ ਦੀ ਸਿਹਤ ਸੰਭਾਲ ਨਹੀਂ ਕਰਦੇ ਉਦੋਂ ਤੱਕ ਅਸੀਂ ਕੁਛ ਨਹੀਂ ਕਰ ਸਕਦੇ ਸਾਡੇ ਡਾਕਟਰ ਹੈ ਜਾਂ ਨਰਸਾਂ ਜਾਂ ਜੋ ਵੀ ਸਿਹਤ ਸੁਵਿਧਾਵਾਂ ਹਨ ਉਹ ਉਦੋਂ ਉਹ ਬਿਲਕੁਲ ਇੱਕ ਸੀਮਿਤ ਅਦਾਰੇ ਦੇ ਅੰਦਰ ਜਦੋਂ ਤੱਕ ਅਸੀਂ ਖੁਦ ਨੂੰ ਆਪਣੇ ਆਪ ਨੂੰ ਸਿਹਤ ਸੰਭਾਲ ਆਪਣੀ ਸਾਫ਼ ਸਫਾਈ ਨਹੀਂ ਰੱਖ ਸਕਦੇ ਆਪਣੇ ਪਰਿਵਾਰ ਦਾ ਆਪਣੇ ਘਰ ਦਾ ਆਲਾ ਦੁਆਲਾ ਸਾਫ਼ ਨਹੀਂ ਕਰ ਸਕਦੇ ਉਦੋਂ ਤੱਕ ਅਸੀਂ ਆਪਣੀ ਕੋਈ ਵੀ ਸੁਵਿਧਾ ਨਹੀਂ ਲੈ ਸਕਦੇ